ਹਾਂ ਸਾਡੇ ਕੋਲ ਆਪਣੇ ਸੰਗ੍ਰਹਿ ਲਈ ਕਈ ਖਾਸ ਗੋਲ ਅਤੇ ਛਾਵਾਂ ਹਨ ਮੇਰੇ ਬਹੁਤ ਸਾਰੇ ਗੋਲ ਹਨ ਜਿਵੇਂ ਕਿ ਬਾਹਰ ਜੰਗਲਾਂ ਅਤੇ ਪਹਾੜਾਂ ਦੀ ਸੈਰ ਕਰਨਾ ਦੂਰ ਦੂਰ ਜਾ ਕੇ ਦੁਨੀਆਂ ਦੇ ਰੰਗ ਰੂਪ ਦੇਖਣਾ ਮੇਰੀ ਬਹੁਤ ਸੀ ਇਛਾਵਾਂ ਹਨ ਜਿਨਾਂ ਕਰਕੇ ਮੈਂ ਬਹੁਤ ਹੀ ਇੱਛਾ ਰੱਖੀਆਂ ਹਨ ਅਤੇ ਮੇਰੀਆਂ ਇੱਛਾਵਾਂ ਬਹੁਤ ਹੀ ਜਿਆਦਾ ਜਰੂਰੀ ਹਨ ਮੈਂ ਚਾਹੁੰਦਾ ਹਾਂ ਕਿ ਮੈਂ ਇਕੱਲਾ ਬਹੁਤ ਜਿੱਥੇ ਜਾਵਾਂ ਜਿੱਥੇ ਮੇਰੀਆਂ ਇੱਛਾਵਾਂ ਹਨ ਜੋ ਮੈਂ ਚਾਹੁੰਦਾ ਹਾਂ ਉਹ ਮੈਂ ਕਰ ਪਾਵਾਂ ਮੈਂ ਵੱਡੇ ਵੱਡੇ ਪਹਾੜਾਂ ਅਤੇ ਜੰਗਲਾਂ ਦੀ ਸੈਰ ਕਰਾਂ ਉਥੋਂ ਦੀ ਖੂਬਸੂਰਤੀ ਨੂੰ ਦੇਖਾਂ ਤੇ ਆਪਣੇ ਮਨ ਨੂੰ ਸੰਤੁਲਨ ਦਵਾਂ ਮੇਰਾ ਬਹੁਤ ਵੱਡਾ ਗੋਲ ਇੱਕ ਇਹ ਵੀ ਹੈ ਕਿ ਮੈਂ ਬਹੁਤ ਹੀ ਵੱਡਾ ਇੱਕ ਬਿਜ਼ਨਸਮੈਨ ਬਣਨਾ ਚਾਹੁੰਦਾ ਹਾਂ ਇੱਕ ਵਪਾਰੀ ਬਣਨਾ ਚਾਹੁੰਦਾ ਹਾਂ ਤੇ ਮੈਂ ਵਪਾਰ ਕਰਕੇ ਇਸ ਦੁਨੀਆ ਵਿੱਚ ਆਪਣਾ ਇੱਕ ਨਾਮ ਬਣਾਉਣਾ ਚਾਹੁੰਦਾ ਹਾਂ ਅਤੇ ਮੇਰੇ ਬਹੁਤ ਸਾਰੇ ਗੋਲ ਹਨ ਮੇਰੇ ਯਾਰਾ ਬੇਲੀਆਂ ਦੇ ਵੀ ਬਹੁਤ ਗੋਲ ਹਨ ਕੁਝ ਮਕੈਨਿਕ ਬਣਨਾ ਚਾਹੁੰਦੇ ਹਨ ਕੁਝ ਇੰਜੀਨੀਅਰ ਬਣਨਾ ਚਾਹੁੰਦੇ ਹਨ ਕੁਝ ਡਾਕਟਰ ਬਣਨਾ ਚਾਹੁੰਦੇ ਹਨ ਉਹ ਆਪਣੀ ਮਿਹਨਤ ਵਿੱਚ ਪੂਰਾ ਲਗਨ ਵਿੱਚ ਲਗਨ ਨਾਲ ਲੱਗੇ ਹੋਏ ਹਨ ਅਤੇ ਉਹ ਆਪਣੇ ਗੋਲ ਵਿੱਚ ਪੂਰਾ ਧਿਆਨ ਦੇ ਰਹੇ ਹਨ ਉਹਨਾਂ ਦੇ ਗੋਲ ਵਿੱਚ ਉਹਨਾਂ ਦੀ ਮਦਦ ਮੈਂ ਵੀ ਕਰ ਰਿਹਾ ਤੇ ਮੇਰੀਆਂ ਇੱਛਾਵਾਂ ਅਤੇ ਮੇਰਾ ਗੋਲ ਪੂਰਾ ਕਰਨ ਲਈ ਮੇਰੇ ਯਾਰ ਬੇਲੀ ਵੀ ਮੇਰਾ ਸਹਿਯੋ ਸਹਿਯੋਗ ਕਰ ਰਹੇ ਹਨ ਅਤੇ ਉਹਨਾਂ ਦੇ ਸਹਿਯੋਗ ਨਾਲ ਮੈਂ ਇੱਕ ਦਿਨ ਆਪਣੇ ਗੋਲ ਨੂੰ ਪ੍ਰਾਪਤ ਕਰ ਲਵਾਂਗਾ ਅਤੇ ਮੈਂ ਆਪਣੀ ਇੱਛਾਵਾਂ ਜੋ ਕਿ ਮੈਂ ਪਹਾੜਾਂ ਤੇ ਜੰਗਲਾਂ ਵਿੱਚ ਜਾਣਾ ਚਾਹੁੰਦਾ ਹਾਂ ਉਨਾਂ ਦੀਆਂ ਪੁਰਾਣੀਆਂ ਗੱਲਾਂ ਜੋ ਕੀ ਮੈਂ ਜਾਣਨਾ ਚਾਹੁੰਦਾ ਹਾਂ ਕੀ ਇਹ ਚਟਾਨਾ ਪਹਾੜ ਕਦੋਂ ਬਣੇ ਕਿੱਥੋਂ ਆਏ ਤੇ ਕਿਵੇਂ ਆਏ ਇਹ ਜੰਗਲ ਕਿਵੇਂ ਬਣੇ ਇਹਨਾਂ ਦੇ ਜੰਗਲਾਂ ਵਿੱਚ ਰਹਿਣ ਵਾਲੇ ਜਾਨਵਰ ਕਿੱਥੋਂ ਆਏ ਅਤੇ ਕਿਵੇਂ ਆਏ ਇਹਨਾਂ ਦਾ ਪੁਰਾਣਾ ਇਤਿਹਾਸ ਕੀ ਹੈ